ਸਤਿ ਸ਼੍ਰੀ ਅਕਾਲ ਸਾਨੂੰ ਘੁ ਘੁੰਮਣ ਲਈ ਅੰਮ੍ਰਿਤਸਰ ਜ਼ਰੂਰ ਹੀ ਜਾਣਾ ਚਾਹੀਦਾ ਹੈ ਉਹ ਭਾਰਤ ਵਿੱਚ ਹੈ ਅੰਮ੍ਰਿਤਸਰ ਇਸ ਲਈ ਜਾਣਾ ਚਾਹੀਦਾ ਹੈ ਕਿਉਂਕਿ ਉਹ ਗੁਰੂ ਪੀਰਾਂ ਦੀ ਧਰਤੀ ਹੈ ਅੰਮ੍ਰਿਤਸਰ ਇੱਕ ਨਹੀਂ ਬਹੁਤ ਸਾਰੇ ਗੁਰੂਆਂ ਦੀ ਗੁਰੂਆਂ ਪੀਰਾਂ ਦੀ ਦੇ ਸਥਾਨ ਹਨ ਜਿੱਦਾਂ ਕਿ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਹਨ ਉਹ ਦਰਵਾਜ਼ੇ ਇਹ ਦਰਸਾਉਂਦੇ ਹਨ ਕਿ ਇੱਥੇ ਅਲੱਗ ਅਲੱਗ ਧਰਮ ਦੇ ਲੋਕ ਆ ਸਕਦੇ ਹਨ ਤ ਹਰਿਮੰਦਰ ਸਾਹਿਬ ਦੀ ਨੀਂਹ ਸਾਈ ਮੀਆਂ ਮੀਰ ਨੇ ਰੱਖੀ ਸੀ ਜਦੋਂ ਆਪਾਂ ਉਥੇ ਜਾਂਦੇ ਹਾਂ ਤਾਂ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਹੈ ਗੋਬਿੰਦਗੜ ਕਿਲ੍ਹਾ ਕਿਲ੍ਹਾ ਜਿਹੜਾ ਕਿ ਰ ਰ ਜਿੱਥੇ ਕਿ ਰਣਜੀਤ ਸਿੰਘ ਦਾ ਜੋ ਕਿ ਰਣਜੀਤ ਸਿੰਘ ਦਾ ਕਿਲ੍ਹਾ ਸੀ ਜਦੋਂ ਆਪਾਂ ਉੱਥੇ ਜਾਈਏ ਤਾਂ ਰਣਜੀਤ ਸਿੰਘ ਦੇ ਇਤਿਹਾਸ ਦਾ ਜਾਨਣ ਲਈ ਬਹੁਤ ਹੀ ਕੁਛ ਸਿੱਖਣ ਨੂੰ ਮਿਲਦਾ ਹੈ ਇਸ ਦੋ ਨੇ ਦੋ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਸਥਾਨ ਹਨ ਇਸ ਤੋਂ ਬਾਅਦ ਜੇ ਅਗ ਕਿਤੇ ਹੋਰ ਜਾ ਘੁੰਮਣ ਬਾ ਬਾਰੇ ਦੱਸਣਾ ਹੋਵੇ ਤਾਂ ਜਲੰਧਰ ਸਾਇੰਸ ਸਿਟੀ ਤਾਂ ਪੱਕਾ ਹੀ ਜਾਣਾ ਚਾਹੀਦਾ ਹੈ ਜਾਣਾ ਚਾਹੀਦਾ ਹੈ ਮੈਂ ਉੱਥੋਂ ਦੋ ਵਾਰ ਹੋ ਕੇ ਆਈ ਹਾਂ ਉੱਥੋਂ ਦਾ ਅਨੁਭਵ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਉੱਥੇ ਸਾ ਉੱਥੇ ਸਾਇੰਸ ਬਾਰੇ ਬਹੁਤ ਹੀ ਕੁਛ ਦੱਸਿਆ ਹੋਇਆ ਸੀ ਉੱਥੇ ਊਠ ਬਣਾਏ ਹੋਏ ਸੀ ਜੋ ਕਿ ਦੇਖਣ 'ਚ ਲੱਗਦੇ ਸੀ ਕਿ ਅਸਲੀ ਹਨ ਜਦੋਂ ਆਪਾਂ ਉਸਦੇ ਕੋਲ ਗਏ ਹੱਥ ਲਗਾਇਆ ਤਾਂ ਫਿਰ ਪਤਾ ਲੱਗਿਆ ਇਹ ਤਾਂ ਨਕਲੀ ਸਨ ਉੱਥੇ ਇੱਕ ਘੜੀ ਦਿਖਾਈ ਹੋਈ ਸੀ ਜਿਸ ਵਿੱਚ ਸੂਰਜ ਦੀਆਂ ਕਿਰਨਾਂ ਪੈਣ 'ਤੇ ਉਸਦਾ ਟਾਈਮ ਨੂੰ ਦਿਖਾਇਆ ਗਿਆ ਸੀ ਉੱਥੇ ਇੱਕ ਗੇਮ ਸੀ ਜਦੋਂ ਆਪਾਂ ਉਸ ਦੇ ਵਿੱਚ ਐਂਟਰ ਹੋਏ ਉੱ ਉੱਥੇ ਬਹੁਤ ਸਾਰਾ ਹਨੇਰਾ ਸੀ ਜਦੋਂ ਆਪਾਂ ਉਹਦੇ ਵਿੱਚ ਐਂਟਰ ਹੋਏ ਤਾਂ ਇੱਦਾਂ ਲੱਗਿਆ ਕਿ ਸਾਡੀ ਲੱਤਾਂ ਉੱਤੇ ਔਰ ਸੀਟ ਨੀਚੇ ਹੈ ਪਰ ਦੇਖਣ ਵਿੱਚ ਇੱਦਾਂ ਦਾ ਕੁਛ ਨਹੀਂ ਸੀ ਉਹ ਆਪਣੇ ਇੱਕ ਦਿਲ ਦਾ ਵਹਿਮ ਸੀ ਉੱਥੇ ਵੀ ਜਾ ਕੇ ਬਹੁਤ ਮਜ਼ਾ ਆਇਆ ਉੱਥੇ ਹੋਰ ਵੀ ਬਹੁਤ ਕੁਛ ਸਿੱਖਣੇ ਸਿੱਖਣੇ ਸੀ ਅਗਰ ਆਪਾਂ ਕਿਸੇ ਹੋਰ ਗੱਲ ਘੁੰਮਣ ਦੀ ਗੱਲ ਕਰਨੀ ਹੋਈਏ ਕਿ ਕਿਸੇ ਹੋਰ ਹੋਰ ਕਿਹੜੀ ਜਗ੍ਹਾ ਜਿੱਥੇ ਆਪਾਂ ਘੁੰਮ ਸਕਦੇ ਹਾਂ ਆਪਾਂ ਉੱਤਰ ਪ੍ਰਦੇਸ਼ ਵਿੱਚ ਜਾ ਸਕਦੇ ਆ ਜਿੱਥੇ ਮਥੁਰਾ ਦੀ ਇੱਕ ਜਗ੍ਹਾ ਹੈ ਜਿੱਥੇ ਕ੍ਰਿਸ਼ਨ ਜੀ ਦਾ ਵਾਸ ਹੋਇਆ ਸੀ ਥੈਂਕ ਧੰਨਵਾਦ ਜੀ